ਮੈਂ ਆਪਣੀ ਸਹੇਲੀ ਦੇ ਕਹਿਣ 'ਤੇ ਇੰਟਰਨੈਸ਼ਨਲ ਸ਼ੈਂਪੂ ਮੰਗਵਾਇਆ ਸੀ ਕਿਉਂਕਿ ਮੇਰੇ ਵਾਲ਼ ਬਹੁਤ ਝੜਦੇ ਸੀ ਅਤੇ ਵਾਲ਼ ਵੀ ਬਹੁਤ ਰੁੱਖੇ ਸਨ ਇਸ ਲਈ ਮੈਂ ਇਸ ਸ਼ੈਂਪੂ ਦੀ ਵਰਤੋਂ ਕੀਤੀ ਸੀ ਪਰ ਇਸਦੀ ਵਰਤੋਂ ਕਰਨ ਨਾਲ਼ ਮੇਰੇ ਵਾਲ਼ਾਂ ਦੀ ਮੁਸ਼ਕਲ ਦੂਰ ਤਾਂ ਕੀ ਹੋਰ ਵੀ ਵਧ ਗਈ ਹੈ ਮੇਰੇ ਵਾਲ਼ ਅੱਗੇ ਨਾਲ਼ੋਂ ਜ਼ਿਆਦਾ ਝੜਨ ਲੱਗ ਪਏ ਹਨ ਅਤੇ ਵਾਲ਼ਾਂ ਵਿੱਚ ਸਿਕਰੀ ਦੀ ਮਾਤਰਾ ਵੀ ਵੱਧ ਗਈ ਹੈ ਵਾਲ਼ਾਂ ਵਿੱਚ ਖਾਰਿਸ਼ ਦੀ ਸਮੱਸਿਆ ਵੀ ਸ਼ੁਰੂ ਹੋ ਗਈ ਹੈ ਇਸਦੇ ਪੈਸੇ ਵੀ ਬਹੁਤ ਦਿੱਤੇ ਸਨ ਇਹ ਮਹਿੰਗਾ ਹੋਣ ਕਾਰਨ ਮੈਨੂੰ ਇਹ ਸੀ ਕਿ ਇਹ ਬਹੁਤ ਵਧੀਆ ਹੈ ਪ੍ਰੰਤੂ ਇਸਨੇ ਮੇਰੇ ਵਾਲ਼ ਬਹੁਤ ਝੜ ਦਿੱਤੇ ਹਨ ਮੈਨੂੰ ਲੈਣ ਵਧੀਆ ਸ਼ੈਂਪੂ ਲੈਣ ਦੇ ਬਾਵਜੂਦ ਇਸਦਾ ਅਨੁਭਵ ਮੇਰੇ ਲਈ ਬਿਲਕੁਲ ਚੰਗਾ ਨਹੀਂ ਰਿਹਾ